ਇੱਕ ਵਾਰ ਨਾ ਮੈਂ ਇੱਕ ਸੂਟ ਲਿਆਂਦਾ ਔਰ ਪਹਿਲਾਂ ਮੈਨੂੰ ਬਹੁਤ ਸੋਹਣਾ ਲੱਗਿਆ ਫਿਰ ਮੈਂ ਔਡਰ ਕਰ ਦਿੱਤਾ ਘਰ ਆਇਆ ਔਰ ਘਰ ਆਇਆ ਔਰ ਇੰਨਾ ਸੋਹਣਾ ਨਹੀਂ ਲੱਗਿਆ ਜਦ ਮੈਂ ਪਾਇਆ ਤਾਂ ਮੇਰੇ 'ਤੇ ਨਹੀਂ ਖਿਲਿਆ ਫਿਰ ਮੈਂ ਉਹਨੂੰ ਧੋ ਦਿੱਤਾ ਧੋ ਦਿੱਤਾ ਅਤੇ ਉਸਦਾ ਰੰਗ ਉੱਤਰ ਗਿਆ ਉਸ ਸੂਟ ਦੇ ਪ੍ਰਤੀ ਮੇਰਾ ਐਕਸਪੀਰੀਐਂਸ ਬਹੁਤ ਮਾੜਾ ਰਿਹਾ